ਹਾਂਜੀ ਜਨਮਦਿਨ ਤਾਂ ਅਸੀਂ ਘਰ ਵਿੱਚ ਹੀ ਮਤਲਬ ਬੱਚਿਆਂ ਨਾਲ ਹੀ ਮਨਾਉਂਦੇ ਹਾਂ ਫੈਮਲੀ ਨਾਲ ਹੀ ਕਿਉਂਕਿ ਜੇ ਆਪਾਂ ਬਰਡੇ ਪਾਰਟੀ ਰੱਖ ਲੈਂਦੇ ਹਾਂ ਫਿਰ ਲੋਕਾਂ ਨੂੰ ਇਨਵਾਈਟ ਕਰਦੇ ਹਾਂ ਤਾਂ ਇਹੋ ਜਿਹਾ ਫੀਲ ਹੁੰਦਾ ਰਹਿੰਦਾ ਕਿ ਅਗਲੇ ਨੂੰ ਐਂ ਹੁੰਦਾ ਹੁਣ ਮੈਂ ਜਾਣਾ ਤਾਂ ਮੈਂ ਕੋਈ ਗਿਫਟ ਲੈ ਕੇ ਜਾਵਾਂ ਫਿਰ ਇਹ ਫੀਲ ਹੁੰਦਾ ਵੀ ਅਗਲੇ 'ਤੇ ਇੱਕ ਬਰਡਨ ਜਿਹਾ ਪੈ ਜਾਂਦਾ ਇਸ ਲਈ ਬਰਥਡੇ ਘਰੇ ਘਰੇ ਸੈਲੀਬਰੇਟ ਕਰਦੇ ਹਾਂ ਅਤੇ ਗੁਰਦੁਆਰਾ ਸਾਹਿਬ ਜਾ ਆਉਂਦੇ ਹਾਂ ਉੱਥੇ ਕੋਈ ਦਾਨ ਦਕਸ਼ਣਾ ਦੇ ਆਉਂਦੇ ਹਾਂ ਜਾਂ ਕਿਸੇ ਗਰੀਬ ਨੂੰ ਉਸ ਦਿਨ ਕੁਛ ਦਾਨ ਦੇ ਦਿੰਦੇ ਹੈਗੇ ਅਤੇ ਵਿਆਹ ਆਪਣੇ ਵਧੀਆ ਹੁੰਦੇ ਆ ਸਾਰਿਆਂ ਦੇ ਪੰਜਾਬੀਆਂ ਦੇ ਤੁਹਾਨੂੰ ਪਤਾ ਹੀ ਹੋਣਾ ਅਤੇ ਜਿਵੇਂ ਵਿਆਹ ਤੋਂ ਮਤਲਬ ਵਿਆਹ ਵਾਲੀ ਤਰੀਕ ਤੋਂ ਹਫਤਾ ਪਹਿਲਾਂ ਹੀ ਵਿਆਹ ਸ਼ੁਰੂ ਹੋ ਜਾਂਦਾ ਘਰੇ ਕੁੜੀ ਦਾ ਵਿਆਹ ਹੋਵੇ ਮੁੰਡੇ ਦਾ ਵਿਆਹ ਹੋਵੇ ਗੀਤ ਬਿਠਾਏ ਜਾਂਦੇ ਆ ਫਿਰ ਰਾਤ ਨੂੰ ਗੀਤ ਗਾਉਣ ਵਾਲਿਆਂ ਨੂੰ ਸਾਰਿਆਂ ਨੂੰ ਮਿੱਠਾ ਮਤਲਬ ਪਤਾਸੇ ਜਾਂ ਗੁੜ ਵਗੈਰਾ ਦੇ ਕੇ ਤੋਰਿਆ ਜਾਂਦਾ ਵਿਆਹ ਮਤਲਬ ਪੂਰਾ ਵਧੀਆ ਬਣ ਜਾਂਦਾ ਅਤੇ ਦੋਸਤਾਂ ਦਾ ਵੀ ਕੋਈ ਹੋਵੇ ਸੈਲੀਬਰੇਸ਼ਨ ਤਾਂ ਉਹ ਵੀ ਵਧੀਆ ਹੀ ਕਰ ਲਈਦਾ ਪਰ ਘਰ ਹੀ ਬਾਹਰ ਜਾਣ ਦੀ ਬਜਾਏ ਘਰ 'ਚ ਹੀ ਬਣਾਉਣਾ ਮੈਂ ਤਾਂ ਪ੍ਰੈਫਰ ਕਰਦੀ ਹਾਂ ਵੀ ਓਨਾ ਹੀ ਖਰਚਾ ਬਾਹਰ ਹੋ ਜਾਂਦਾ ਤਾਂ ਓਨਾ ਆਪਾਂ ਘਰ ਜ਼ਿਆਦਾ ਬੈਟਰ ਬਣਾ ਸਕਦੇ ਹਾਂ ਅਤੇ ਨਾਲੇ ਆਪ ਦੀ ਬਣਾਈ ਚੀਜ਼ ਦਾ ਤੁਹਾਨੂੰ ਤਸੱਲੀ ਹੁੰਦੀ ਹੈ ਕਿ ਤੁਸੀਂ ਵਧੀਆ ਬਣਾਈ ਹੋਊਗੀ ਬਾਹਰ ਦੇ ਖਾਣੇ ਖਾ ਖਾ ਕੇ ਤਾਂ ਸਾਰਿਆਂ ਨੇ ਬਿਮਾਰ ਹੀ ਹੋਣਾ ਹੁੰਦਾ